ਅਸੀਂ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦਾ ਕੰਮ ਲੈਂਦੇ ਹਾਂ ਕਈ ਵਾਰ ਕਈ ਕੱਪੜਿਆਂ ਨੂੰ ਹੱਥਾਂ ਨਾਲ ਵੀ ਧੋਣਾ ਪੈ ਜਾਂਦਾ ਹੈ ਕਿਉਂਕਿ ਕੱਪੜਿਆਂ ਦੀਆਂ ਕੁਆਲਿਟੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਕਈ ਕੱਪੜੇ ਵਸ਼ਿੰਗ ਮਸ਼ੀਨ ਵਿੱਚ ਧੋਣ ਨਾਲ ਉਹਨਾਂ ਦੇ ਕੁਆਲਿਟੀਆਂ ਵਧੀਆ ਰਹਿੰਦੀਆਂ ਹਨ ਅਤੇ ਕਈ ਕੱਪੜੇ ਹੱਥਾਂ ਨਾਲ ਧੋਣ ਨਾਲ ਉਹਨਾਂ ਦਾ ਕੱਪੜਾ ਵਧੀਆ ਅਤੇ ਸਾਫ਼ ਰਹਿੰਦਾ ਹੈ ਜਿਸ ਤਰ੍ਹਾਂ ਕੱਪੜੇ ਸੁਕਾਉਣ ਨੂੰ ਲੈ ਕੇ ਗਰਮੀਆਂ ਦੇ ਦਿਨਾਂ ਵਿੱਚ ਤਾਂ ਉਹਨਾਂ ਕੱਪੜਿਆਂ ਨੂੰ ਬਾਹਰ ਵੇਹੜਿਆਂ ਵਿੱਚ ਉੱਪਰ ਕੋਠਿਆਂ ਦੇ ਤਾਰਾਂ ਉੱਪਰ ਸੁੱਕਣੇ ਪਾ ਦਿੱਤੇ ਜਾਂਦੇ ਹਨ ਕਿਉਂਕਿ ਗਰਮੀਆਂ ਵਿੱਚ ਧੁੱਪ ਬਹੁਤ ਕੜਾਕੇਦਾਰ ਪੈਂਦੀ ਹੈ ਜਿਸ ਕਰਕੇ ਕੱਪੜੇ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਸੁੱਕ ਜਾਂਦੇ ਹਨ ਇਸ ਦੇ ਇਲਾਵਾ ਜਦੋਂ ਠੰਡ ਦਾ ਮੌਸਮ ਹੁੰਦਾ ਹੈ ਤਾਂ ਕੱਪੜੇ ਸੁਕਾਉਣ ਲਈ ਮਸ਼ੀਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਨਾਲ ਕਿ ਕੱਪੜੇ ਅੱਧੇ ਸੁੱਕ ਜਾਂਦੇ ਹਨ ਅਤੇ ਅੱਧੇ ਕੱਪੜੇ ਬਾਹਰ ਤਾਰਾਂ 'ਤੇ ਪਾ ਕੇ ਹੀ ਸੁਕਾਏ ਜਾਂਦੇ ਹਨ